ਸਾਡੇ ਮੋਹਾਲੀ ਵਿੱਚ ਬਹੁਤ ਹੀ ਜ਼ਿਆਦਾ ਵੱਡੀਆਂ ਵੱਡੀਆਂ ਥੀਮ ਪਾਰਕਸ ਹਨ ਜਿਵੇਂ ਥੰਡਰ ਜ਼ੌਨ ਹੋ ਗਿਆ ਵਾਟਰ ਪਾਰਕਸ ਹੋ ਗਈਆਂ ਜਿੱਥੇ ਜਾ ਕੇ ਇਹ ਸਾਰੇ ਜੀਆਂ ਨੂੰ ਹੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਸਾਰੇ ਹੀ ਬਹੁਤ ਜ਼ਿਆਦਾ ਇੰਨਜੋਏ ਕਰਦੇ ਹਨ ਅਤੇ ਇੱਥੇ ਮੈਂ ਆਪਣੀ ਫੈਮਿਲੀਜ਼ ਨਾਲ਼ ਐਜ ਅ ਟਰਿੱਪ 'ਤੇ ਗਈ ਸੀਗੀ ਅਤੇ ਉੱਥੇ ਜਾ ਕੇ ਅਸੀਂ ਬਹੁਤ ਹੀ ਇੰਨਜੋਏ ਕਰਿਆ ਅਤੇ ਮੈਂ ਚਿੜੀਆ ਘਰ ਵੀ ਗਈ ਹੋਈ ਹਾਂ ਆਪਣੀ ਫੈਮਿਲੀ ਨਾਲ਼ ਜਿੱਥੇ ਮੈਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਾਨਵਰ ਦੇਖੇ ਜਿਹੜੇ ਕਿ ਮੈਂ ਆਪਣੀ ਲਾਈਫ਼ 'ਚ ਨਹੀਂ ਦੇਖੇ ਜਿਵੇਂ ਕਿ ਸ਼ੇਰ ਹੋ ਗਿਆ ਜੋ ਕਿ ਸਾਨੂੰ ਆਮ ਖਾਸ ਅਤੇ ਲਾਗ ਨੇੜੇ ਨਹੀਂ ਮਿਲਦਾ ਅਤੇ ਮੈਂ ਉੱਥੇ ਬਹੁਤ ਹੀ ਜ਼ਿਆਦਾ ਐਕਸਪਲੋਰ ਕੀਤਾ ਅਤੇ ਮੈਂ ਨਵੇਂ ਨਵਿਆਂ ਜਾਨਵਰਾਂ ਬਾਰੇ ਜਾਣਕਾਰੀ ਲੀਤੀ ਅਤੇ ਮੈਂ ਉੱਥੇ ਬਹੁਤ ਵੱਡੇ ਵੱਡੇ ਸੱਪ ਵੀ ਦੇਖੇ ਜਿਹੜੇ ਕਿ ਆਮ ਤੌਰ 'ਤੇ ਸਾਨੂੰ ਕੀਤੇ ਵੀ ਦੇਖਣ ਨੂੰ ਨਹੀਂ ਮਿਲਦੇ ਹੈਗੇ ਅਤੇ ਥੀਮ ਪਾਰਕਸ ਵਿੱਚ ਅਸੀਂ ਐਜ ਅ ਵਾਟਰ ਬਹੁਤ ਜ਼ਿਆਦਾ ਇੰਨਜੋਏ ਕੀਤਾ ਪੂਰੀ ਫੈਮਿਲੀ ਨੇ ਅਸੀਂ ਬਹੁਤ ਹੀ ਜ਼ਿਆਦਾ ਚਿੱਲ ਆਊਟ ਕਰਿਆ ਅਤੇ ਅਸੀਂ ਸਾਰੀ ਫੈਮਿਲੀ ਇਕੱਠੀ ਹੋ ਕੇ ਗਈ ਸੀਗੀ ਅਤੇ ਮੇਰੀ ਸਾਰੀ ਫੈਮਿਲੀ ਬਹੁਤ ਹੀ ਖੁਸ਼ ਹੋਈ ਅਤੇ ਅਸੀਂ ਰਲ਼ ਕੇ ਸਾਰਿਆਂ ਨੇ ਉੱਥੇ ਫੂਡ ਵੀ ਇੰਨਜੋਏ ਕੀਤਾ ਐਜ ਅ ਟਰੀਟ ਅਸੀਂ ਸਾਰਿਆਂ ਨੇ ਬੈਠ ਕੇ ਇਕੱਠਿਆਂ ਨੇ ਅਸੀਂ ਡਰਿੰਕਜ਼ ਹੋ ਗਏ ਅਸੀਂ ਸਾਰਿਆਂ ਨੇ ਹੀ ਬੈਠ ਕੇ ਖਾਇਆ